ਖਾਣਾ ਬਣਾਉਣ ਵੇਲੇ ਆਟਾ ਗੁੰਨਣ ਲਈ ਆਮ ਤੌਰ 'ਤੇ ਜੋ ਬਰਤਨ ਦੀ ਵਰਤੋਂ ਹੁੰਦੀ ਆ ਉਸਨੂੰ ਪਰਾਤ ਕਹਿੰਦੇ ਹਨ ਅਤੇ ਉਸ ਤੋਂ ਇਲਾਵਾ ਜੋ ਕੁੱਕਰ ਹੈ ਤੁੱਕਸ ਹੈ ਕੜਾਹੀ ਹੈ ਅਤੇ ਤਿਆਰ ਕੀਤੇ ਜਾਣ ਵਾਲੇ ਭੋਜਨ ਨੂੰ ਹਿਲਾਉਣ ਦੇ ਲਈ ਜੋ ਕੜਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾਲ ਹੀ ਤਵੇ ਦੇ ਉੱਤੇ ਰੋਟੀ ਨੂੰ ਗਰਮ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਪੂਰੀਆਂ ਨੂੰ ਤਿਆਰ ਕਰਨ ਦੇ ਲਈ ਕੜਾਹੀ ਦੇ ਵਿੱਚ ਤੇਲ ਨੂੰ ਗਰਮ ਕਰਕੇ ਅਤੇ ਫਿਰ ਉਹਦੇ ਵਿੱਚ ਤਲਿਆ ਜਾਂਦਾ ਹੈ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਖ ਵੱਖ ਪ੍ਰਕਾਰ ਦੇ ਬਰਤਨ ਹਨ ਜਿਵੇਂ ਕਿ ਪਾਣੀ ਦਾ ਜੱਗ ਹੈ ਜਾਂ ਚਮਚ ਨੇ ਪਲੇਟਾਂ ਨੇ ਕੌਲੀਆਂ ਨੇ ਅਤੇ ਇਹ ਸਾਰੀਆਂ ਜੋ ਭੋਜਨ ਬਣਾਉਣ ਤੇ ਨਾਲ ਹੀ ਛਕਣ ਛਕਾਉਣ ਦੇ ਲਈ ਵੀ ਇਹਨਾਂ ਦੀ ਵਰਤੋਂ ਹੁੰਦੀ ਹੈ